ਹਾਂਜੀ ਮੈਂ ਸਕਰੈਚ ਤੋਂ ਪਕਵਾਨ ਤਿਆਰ ਕੀਤਾ ਹੈ ਮੈਂ ਘਰ ਪਿੱਜ਼ਾ ਬਣਾਇਆ ਸੀਗਾ ਜੇ ਆਪਾਂ ਬਾਹਰ ਦੀ ਗੱਲ ਕਰੀਏ ਤਾਂ ਬਾਹਰ ਪਿੱਜ਼ਾ ਮੈਦੇ ਦਾ ਬਣਿਆ ਹੁੰਦਾ ਹੈ ਆਪਾਂ ਨੂੰ ਇਹ ਨਹੀਂ ਪਤਾ ਉਹਦੇ ਵਿੱਚ ਕਿਵੇਂ ਕਿਵੇਂ ਦੇ ਪ੍ਰਿਜ਼ਰਵੇਟਿਵ ਕੀ ਕੀ ਚੀਜ਼ਾਂ ਬਾਹਰ ਦੀਆਂ ਪਾਈਆਂ ਹੁੰਦੀਆਂ ਹਨ ਜਿਹੜੀਆਂ ਕਿ ਸਿਹਤ ਲਈ ਕਾਫ਼ੀ ਹਾਨੀਕਾਰਕ ਸਾਬਿਤ ਹੁੰਦੀਆਂ ਹਨ ਅਤੇ ਉਹਨਾਂ ਦੇ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ ਸੋ ਮੈਂ ਸੋਚਿਆ ਕਿ ਪਿੱਜ਼ੇ ਦਾ ਸਵਾਦ ਵੀ ਲੈਣਾ ਹੈ ਅਤੇ ਸਿਹਤ ਵੀ ਨਹੀਂ ਖ਼ਰਾਬ ਕਰਨੀ ਹੈਗੀ ਸੋ ਚੰਗੀ ਸਿਹਤ ਅਪਣਾਉਣ ਦੇ ਲਈ ਮੈਨੂੰ ਇ ਇਸੇ ਚੀਜ਼ ਨੇ ਪ੍ਰੇਰਿਤ ਕੀਤਾ ਕਿ ਕਿਉਂ ਨਾ ਮੈਂ ਪਿੱਜ਼ਾ ਹੈ ਜਿਹੜਾ ਉਹ ਘਰ ਬਣਾਵਾਂ ਸੋ ਪਿੱਜ਼ਾ ਮੈਂ ਘਰ ਬਣਾਇਆ ਉਹ ਵੀ ਮੈਂ ਮੈਦੇ ਦਾ ਨਾਂ ਬਣਾ ਕੇ ਆਟੇ ਦਾ ਬਣਾਇਆ ਜਿਹਦੇ ਵਿੱਚ ਕੋਈ ਵੀ ਪ੍ਰਿਜਰਵੇਟਿਵ ਨਹੀਂ ਪਾਇਆ ਹੈਗਾ ਉਹਦੇ ਵਿੱਚ ਆਪਾਂ ਸਾਰੇ ਘਰ ਦੇ ਮਸਾਲੇ ਬਣਾ ਪਾਏ ਉਹਨੂੰ ਫਲਾਉਣ ਦੇ ਲਈ ਵੀ ਜੋ ਵੀ ਮਿੱਠਾ ਸੋਡਾ ਵਗੈਰਾ ਪਾਇਆ ਜਾਂਦਾ ਉਹ ਚੀਜ਼ਾਂ ਨੇ ਜਿਹੜੀਆਂ ਉਹਦੇ ਵਿੱਚ ਮੈਂ ਪਾਈਆਂ ਅਤੇ ਉਸ ਤੋਂ ਇਲਾਵਾ ਤਾਜ਼ੀਆਂ ਸਬਜ਼ੀਆਂ ਪਾਈਆਂ ਉਹਦੇ ਵਿੱਚ ਜਿਹੜੀਆਂ ਕਿ ਸਿਹਤ ਨੂੰ ਖ਼ਰਾਬ ਨਾ ਕਰਕੇ ਸਿਹਤ ਨੂੰ ਹੋਰ ਵਧੀਆ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੀਆਂ ਹਨ ਇਸ ਕਰਕੇ ਅੱਗੇ ਨੂੰ ਉਹ ਪਿੱਜ਼ਾ ਜਿਹੜਾ ਉਹ ਘਰ ਬਹੁਤ ਸਭ ਨੇ ਬਹੁਤ ਪਸੰਦ ਵੀ ਕੀਤਾ ਅਤੇ ਇੰਨੀ ਜ਼ਿਆਦਾ ਪ੍ਰਸ਼ੰਸਾ ਹੋਈ ਅਤੇ ਉਸ ਪ੍ਰਸ਼ੰਸਾ ਨੇ ਵੀ ਮੈਨੂੰ ਬਹੁਤ ਪ੍ਰੇਰਿਤ ਕੀਤਾ ਕਿ ਕਿਉਂ ਨਾ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੈਂ ਘਰ ਹੀ ਬਣਾਇਆ ਕਰਾਂ ਸੋ ਸਿਹਤ ਅਤੇ ਪ੍ਰੇਰਨਾ ਅਤੇ ਘਰ ਦੀ ਘਰਦਿਆਂ ਦੇ ਵੱਲੋਂ ਦਿੱਤੀ ਹੋਈ ਸ਼ਾਬਾਸ਼ੀ ਜਿਹੜੀ ਮੈਨੂੰ ਹੈ ਉਹ ਪ੍ਰੇਰਿਤ ਹੁਣ ਵੀ ਕਰਦੀ ਹੈ ਕਿ ਮੈਂ ਸਕਰੈਚ ਤੋਂ ਆ ਜਿਹੜੇ ਉਹ ਪਕਵਾਨ ਬਣਾਇਆ ਕਰਾਂ